ਪਸ਼ੂ ਪਾਲਣ ਦੇ ਨਾਲ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਧੰਦੇ ਕਰ ਸਕਦੇ ਹਾਂ ਜਿਵੇਂ ਕਿ ਮੁਰਗੇ ਮੁਰਗੀਆਂ ਬੱਕਰੇ ਬੱਕਰੀਆਂ ਸੂਰ ਆਦਿ ਨੂੰ ਪਾਲ ਕੇ ਉਸਦਾ ਮਾਸ ਦਾ ਉਤਪਾਦਨ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਭੇਡਾਂ ਆਦਿ ਨੂੰ ਰੱਖ ਕੇ ਉਸ ਤੋਂ ਉੱਨ ਤਿਆਰ ਕਰਕੇ ਉਸਦਾ ਵੀ ਉਤਪਾਦਨ ਕਰ ਸਕਦੇ ਹਾਂ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਧੰਦੇ ਅਪਣਾਏ ਜਾ ਸਕਦੇ ਹਨ